ਸਾਡੇ ਸੱਭਿਆਚਾਰ ਦਾ ਮੁੱਖ ਕਿੱਤਾ ਹੈ ਖੇਤੀਬਾੜੀ ਸਾਡੇ ਪੰਜਾਬ 'ਚ ਜ਼ਿਆਦਾਤਰ ਬੇਸਿਕਲੀ ਖੇਤੀਬਾੜੀ ਹੀ ਕੀਤੀ ਜਾਂਦੀ ਹੈ ਅਤੇ ਕਿਸਾਨ ਬੜੀ ਹੀ ਖੁਸ਼ੀ ਖੁਸ਼ੀ ਨਾਲ ਮਿਹਨਤ ਨਾਲ ਪਹਿਲਾਂ ਖੇਤੀਬਾੜੀ ਕਰਦੇ ਸੀ ਪਰ ਹੁਣ ਜਿਹੜੇ ਅੱਜ ਦੀ ਜਨਰੇਸ਼ਨ ਹੈ ਉਹ ਨਾ ਖੇਤੀਬਾੜੀ 'ਚ ਬਿਲਕੁਲ ਇੰਟਰਸਟ ਨਹੀਂ ਲੈ ਰਹੀ ਕਿਉਂਕਿ ਇਹਦੇ ਕਾਰਨ ਵੀ ਨੇ ਕਈ ਇੱਕ ਤਾਂ ਸਰਕਾਰ ਹੋ ਗਈ ਸਰਕਾਰ ਜ਼ਿਆਦਾ ਕਿਸਾਨਾਂ ਨੂੰ ਮੁਆਵਜ਼ਾ ਹੀ ਨਹੀਂ ਦੇ ਰਹੀ ਅਤੇ ਦੂਜਾ ਇਹ ਫ਼ਸਲ ਵਧੀਆ ਹੁੰਦੀ ਹੈ ਉਹਦਾ ਮੁੱਲ ਨਹੀਂ ਮਿਲਦਾ ਇਸ ਕਰਕੇ ਕਿਸਾਨ ਜਿਹੜੇ ਨੇ ਅੱਜ ਕੱਲ੍ਹ ਖੇਤੀਬਾੜੀ ਨੂੰ ਛੱਡ ਕੇ ਆਪਣੀ ਜ਼ਮੀਨ ਨੂੰ ਠੇਕੇ 'ਤੇ ਦੇ ਦਿੰਦੇ ਨੇ ਜਾਂ ਫਿਰ ਕੀ ਕਰਦੇ ਨੇ ਜ਼ਮੀਨ 'ਤੇ ਉਹ ਕੁਝ ਕੁ ਹੀ ਫਸਲਾਂ ਉਗਾਉਂਦੇ ਨੇ ਜਿਨ੍ਹਾਂ ਤੋਂ ਉਹਨਾਂ ਨੂੰ ਮੁਆਫਾ ਮੁਨਾਫਾ ਅੱਛਾ ਮਿਲ ਜਾਂਦਾ ਇਸ ਤੋਂ ਇਲਾਵਾ ਜਿਹੜੇ ਉਹ ਬੱਚੇ ਨੇ ਆਪਣੇ ਉਹਨਾਂ ਨੂੰ ਤਾਂ ਖੇਤੀਬਾੜੀ ਕਰਨ 'ਚ ਉਹ ਬਿਲਕੁਲ ਹੀ ਉਹਨਾਂ ਦੀ ਉਹ ਦਿਲਚਸਪੀ ਪੈਦਾ ਹੀ ਨਹੀਂ ਕਰ ਰਹੇ ਕਿਸਾਨ ਕੀ ਕਰ ਰਹੇ ਨੇ ਅੱਜ ਆਪਣੇ ਬੱਚਿਆਂ ਨੂੰ ਆਈਲੈਟਸ ਕਰਾ ਕੇ ਬਾਹਰ ਭੇਜੀ ਜਾ ਰਹੇ ਨੇ ਆਪਣੀਆਂ ਜਮੀਨਾਂ ਵੇਚ ਕੇ ਜਦੋਂ ਕਿ ਸਾਡੇ ਅਸੀਂ ਇੰਡੀਆ ਦੇ ਵਿੱਚ ਅਸੀਂ ਖੇਤੀਬਾੜੀ ਕਰੀਏ ਤਾਂ ਉਹਦਾ ਬਹੁਤ ਸਾਨੂੰ ਵਧੀਆ ਮੁੱਲ ਪ੍ਰਾਪਤ ਹੋ ਸਕਦਾ ਪਰ ਸਰਕਾਰ ਦਾ ਵੀ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਰੋਲ ਹੈ ਕਿ ਉਹ ਸਾਨੂੰ ਮੁਆਵਜ਼ਾ ਹੀ ਨਹੀਂ ਦਿੰਦੀ ਕਿਸਾਨਾਂ ਨੂੰ ਅੱਛਾ ਮੁਆਵਜ਼ਾ ਦੇਣ ਤਾਂ ਕਿਉਂ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਅਤੇ ਆਪਣੀਆਂ ਜ਼ਮੀਨਾਂ ਨੂੰ ਠੇਕੇ 'ਤੇ ਦੇਣ ਇਸ ਕਰਕੇ ਸਾਡਾ ਜੋ ਮੇਨ ਸਾਡਾ ਕਿੱਤਾ ਉਹ ਹੈ ਤਾਂ ਖੇਤੀਬਾੜੀ ਪਰ ਲੋਕਾਂ ਦੀ ਹੁਣ ਦਿਲਚਸਪੀ ਇਸ 'ਚ ਘੱਟ ਗਈ ਹੈ ਇਹਦਾ ਮੁੱਖ ਕਾਰਨ ਸਾਡੀਆਂ ਸਰਕਾਰਾਂ ਹੀ ਨੇ ਜੋ ਸਾਨੂੰ ਕਿਸਾਨਾਂ ਨੂੰ ਅੱਛਾ ਮੁਆਵਜ਼ਾ ਨਹੀਂ ਦੇ ਪਾ ਰਹੀਆਂ ਅਤੇ ਸਾਡਾ ਇਹ ਕਿੱਤਾ ਕਿਤੇ ਨਾ ਕਿਤੇ ਅੱਜ ਅਲੋਪ ਹੋ ਚੁੱਕਿਆ ਅਤੇ ਅੱਜ ਸਾਡੇ ਦੇਸ਼ 'ਚ ਖੇਤੀਬਾੜੀ ਦਾ ਕਿੱਤਾ ਮੁੱਖ ਹੋਣ ਦੇ ਬਾਵਜੂਦ ਵੀ ਅਸੀਂ ਬਾਹਰਲੇ ਇਲਾਕਿਆਂ ਤੋਂ ਅਸੀਂ ਫ਼ਸਲਾਂ ਨੂੰ ਕੀ ਹੈ ਕੁਛ ਪ੍ਰੋਡਕਟ ਨੇ ਜੋ ਅਸੀਂ ਬਾਹਰਲੇ ਇਲਾਕਿਆਂ ਤੋਂ ਭਾਰਤ ਦੇ ਵਿੱਚ ਇੰਪੋਰਟ ਕਰ ਰਹੇ ਹਾਂ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਖੇਤੀਬਾੜੀ ਸਾਡੇ ਜੋ ਇੱਥੇ ਮੇਨ ਪ੍ਰੋਡਕਟ ਬਣਦੇ ਸੀ ਉਹ ਕਿਤੇ ਨਾ ਕਿਤੇ ਖੇਤੀਬਾੜੀ ਦਾ ਕਿੱਤਾ ਅੱਜ ਅਲੋਪ ਹੋ ਚੁੱਕਾ